ਸਤਿ ਸ਼੍ਰੀ ਅਕਾਲ ਜੀ ਮੈਂ ਬਲਵੰਤ ਰਾਜ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਜਿਹੜਾ ਹੈ ਸਾਡਾ ਇਹ ਪੂਰੇ ਹਿੰਦੁਸਤਾਨ ਨੂੰ ਖੇਤੀਬਾੜੀ ਦੇ ਹਿਸਾਬ ਨਾਲ ਜਾਣਿਆ ਜਾਂਦਾ ਹੈ ਅਤੇ ਪੂਰੇ ਬਲ ਹਿੰਦੁਸਤਾਨ ਵਿੱਚ ਕਾਫੀ ਹੱਦ ਤੱਕ ਲੋਕਾਂ ਦੇ ਅਨਾਜ ਦੀ ਪੂਰਤੀ ਕਰਦਾ ਹੈ ਇਸਦਾ ਹੀ ਇੱਥੇ ਘੁੰਮਣ ਫਿਰਨ ਅਤੇ ਦੇਸ਼ ਭਗਤਾਂ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਜਗ੍ਹਾ ਜਗ੍ਹਾ ਹਨ ਜਿਵੇਂ ਕਿ ਅਸੀਂ ਅੰਬਰਸਰ ਚੱਲ ਜਾਈਏ ਅਤੇ ਉੱਥੇ ਦਰਬਾਰ ਸਾਹਿਬ ਸ਼੍ਰੀ ਗੋਲਡਨ ਟੈਂਪਲ ਹੈ ਦਰਬਾਰ ਸਾਹਿਬ ਹੈ ਉੱਥੇ ਬਹੁਤ ਪੂਰੀ ਦੁਨੀਆਂ 'ਚੋਂ ਲੋਕ ਘੁੰਮਣ ਆਉਂਦੇ ਹਨ ਉਸ ਦੇ ਨਾਲ ਹੀ ਸਾਰ ਦਰਬਾਰ ਸਾਹਿਬ ਤੋਂ ਨਾਲ ਹੀ ਸਾਡੇ ਜਲਿਆਂਵਾਲਾ ਬਾਗ ਹੈ ਜਲਿਆਂਵਾਲੇ ਬਾਗ ਨੂੰ ਸ਼ਹੀਦਾਂ ਸ਼ਹੀਦ ਨੂੰ ਉੱਥੇ ਜਰਨਲ ਡਾਇਰ ਨੇ ਜਿਹੜਾ ਗੋਲੀਆਂ ਮਾਰ ਕੇ ਲੋਕਾਂ ਨੂੰ ਖੂਹ ਵਿੱਚ ਸ਼ਹੀਦ ਕੀਤਾ ਸੀ ਉਹ ਅਜੇ ਵੀ ਹੈ ਅਤੇ ਅਸੀਂ ਉੱਥੇ ਵੀ ਟੂਰਿਸਟ ਬਹੁਤ ਆਉਂਦੇ ਹਨ ਅਤੇ ਉਹ ਉੱਥੇ ਸਮਾਰਕ ਵੀ ਬਣਿਆ ਹੈ ਉਸ ਤੋਂ ਇਲਾਵਾ ਅਸੀਂ ਜਲੰਧਰ ਆ ਜਾਈਏ ਅਤੇ ਉੱਥੇ ਦੁਰਗਿਆਣਾ ਮੰਦਰ ਹੈ ਅਤੇ ਉੱਥੇ ਹੋਰ ਵੀ ਸਾਰੇ ਬਹੁਤ ਸਾਰੇ ਕਿ ਖੇਡ ਦਾ ਸਮਾਨ ਬਣਦਾ ਹੈ ਅਤੇ ਉਸ ਤੋਂ ਇਲਾਵਾ ਜਿੱਦਾਂ ਅਸੀਂ ਕਹੀਏ ਵੀ ਪਠਾਨਕੋਟ ਆ ਜਾਈਏ ਅਤੇ ਇੱਥੇ ਆਪਣੇ ਰਣਜੀਤ ਸਾਗਰ ਡੈਮ ਹੈ ਬੜਾ ਮਸ਼ਹੂਰ ਹੈ ਉਸ ਦੇ ਬਾਅਦ ਆਪਣੇ ਇੱਥੇ ਹੋਰ ਵੀ ਘੁੰਮਣ ਵਾਲੀਆਂ ਬਹੁਤ ਵਧੀਆ ਵਧੀਆ ਜਗ੍ਹਾ ਹਨ ਅਤੇ ਮੁਕੇਸਰਾਂ ਧਾਮ ਹੈ ਮੁਕੇਸਰਾਂ ਧਾਮ ਅਸੀਂ ਆਪਣੇ ਪਰਿਵਾਰ ਸਹਿਤ ਉੱਥੇ ਘੁੰਮਣ ਜਾ ਸਕਦੇ ਹਾਂ ਜਿੱਥੇ ਮਿੰਨੀ ਗੋਆ ਬਣ ਬਣਿਆ ਹੈ ਉੱਥੇ ਅਸੀਂ ਉੱਥੇ ਵੀ ਘੁੰਮਣ ਜਾ ਸਕਦੇ ਹਾਂ ਧੰਨਵਾਦ ਜੀ